ਕਾਨੂੰਨੀ ਦਸਤਾਵੇਜ਼ ਨੂੰ ਬਣਾਉਣ ਦੀਆਂ ਜੇਕਰ ਅਸੀਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰੀਏ ਤਾਂ ਇਹਨਾਂ ਨੂੰ ਬਣਾਉਣ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਜਿਵੇਂ ਕਿ ਅਸੀਂ ਆਪਣਾ ਆਧਾਰ ਕਾਰਡ ਹੀ ਬਣਾਉਣਾ ਹੋਵੇ ਤਾਂ ਉਹਦੇ ਵਾਸਤੇ ਆਧਾਰ ਕੇਂਦਰ ਸਥਾਪਿਤ ਹਨ ਜਿੱਥੇ ਜਾ ਕੇ ਅਸੀਂ ਆਪਣਾ ਆਧਾਰ ਕਾਰਡ ਬਣਾ ਸਕਦੇ ਹਾਂ ਮੈਰਿਜ ਸਰਟੀਫਿਕੇਟ ਬਣਾਉਣ ਵਾਸਤੇ ਵੀ ਕੇਂਦਰ ਸਥਾਪਿਤ ਹਨ ਹੋਰ ਵੀ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਵੇ ਜਨਮ ਸਰਟੀਫਿਕੇਟ ਆਪਾਂ ਬਣਾਉਣਾ ਹੋਵੇ ਹਰੇਕ ਵਾਸਤੇ ਸਰਕਾਰ ਵੱਲੋਂ ਜ਼ਰੂਰੀ ਕੇਂਦਰ ਬਣੇ ਹੋਏ ਹਨ ਜਿੱਥੇ ਅਸੀਂ ਆਪਣੇ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਆਪਾਂ ਕਾਨੂੰਨੀ ਦਸਤਾਵੇਜ਼ ਬਣਾ ਸਕਦੇ ਹਾਂ ਪਿਛਲੇ ਸਮੇਂ ਵਿੱਚ ਮੈਂ ਆਪਣੇ ਮੈਰਿਜ ਸਰਟੀਫਿਕੇਟ ਨੂੰ ਬੜੇ ਸੌਖੇ ਤਰੀਕੇ ਨਾਲ ਕੇਂਦਰ ਦੇ ਵਿੱਚੋਂ ਸੇਵਾ ਕੇਂਦਰ ਵਿੱਚੋਂ ਬਣਾ ਲਿਆ ਸੀ ਹੈਵੀ ਡਰਾਈਵਿੰਗ ਲਾਇਸੈਂਸ ਮੇਰੇ ਹਿਸਾਬ ਦੇ ਨਾਲ ਦਸਤਾਵੇਜ਼ ਪ੍ਰਾਪਤ ਕਰਨਾ ਔਖਾ ਹੈ